ਮੈਨੂੰ ਪੰਜਾਬੀ ਕਿਤਾਬਾਂ ਪੜ੍ਹਨੀਆਂ ਬਹੁਤ ਹੀ ਪਸੰਦ ਹਨ ਮੈਂ ਪੰਜਾਬੀ ਕਿਤਾਬ ਵਿੱਚ ਮੈਂ ਔਰਤ ਦੀ ਜ਼ਿੰਦਗੀ ਬਾਰੇ ਕਿਤਾਬ ਪੜ੍ਹੀ ਹੈ ਜੋ ਕਿ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਕਿਤਾਬ ਪੜ੍ਹ ਕੇ ਮੈਨੂੰ ਮੈਂ ਸੋਚਿਆ ਕਿ ਔਰਤ ਦੀ ਜ਼ਿੰਦਗੀ ਕੀ ਹੈ ਕੀ ਹੋਣੀ ਚਾਹੀਦੀ ਹੈ ਔਰਤ ਨੂੰ ਆਪਣੀ ਜ਼ਿੰਦਗੀ ਜੀਣ ਲਈ ਆਪਣੇ ਕਿਸੇ 'ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਔਰਤ ਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਣੀ ਚਾਹੀਦੀ ਹੈ ਹਰ ਇੱਕ ਔਰਤ ਨੂੰ ਕਮਾਈ ਕਰਨੀ ਚਾਹੀਦੀ ਹੈ ਪੜ੍ਹ ਲਿਖ ਕੇ ਉਸ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੀਦਾ ਹੈ ਉਸ ਨੂੰ ਕਿਸੇ 'ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਜੇਕਰ ਕੋਈ ਔਰਤ ਕਿਸੇ 'ਤੇ ਡਿਪੈਂਡ ਹੋਵੇਗੀ ਤਾਂ ਉਸ ਨੂੰ ਆਪਣੇ ਉਸ ਦੇ ਅਨੁਸਾਰ ਚਲਣਾ ਪਏਗਾ ਜੇਕਰ ਕੋਈ ਔਰਤ ਵਿਆਹੀ ਹੈ ਤਾਂ ਉਸਨੂੰ ਆਪਣੇ ਘਰ ਵਾਲੇ ਦੇ ਕਹੇ ਅਨੁਸਾਰ ਚਲਣਾ ਪਏਗਾ ਜੇਕਰ ਇਸ ਕਾਰਨ ਉਹ ਆਪਣੀ ਇੱਛਾਵਾਂ ਵੀ ਪੂਰੀਆਂ ਨਹੀਂ ਕਰ ਸਕੇਗੀ ਹਰ ਇੱਕ ਔਰਤ ਨੂੰ ਇਨ ਇਨਪੈਂਡਡ ਨਹੀਂ ਹੋਣਾ ਚਾਹੀਦਾ ਉਸ ਨੂੰ ਆਪਣੀ ਖੁਦ 'ਤੇ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਕਿਸੇ 'ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਇਸ ਨੂੰ ਪੜ੍ਹਨਾ ਲਿਖਣਾ ਚਾਹੀਦਾ ਹੈ ਜਿਸ ਕਾਰਨ ਉਹ ਕਿਸੇ ਵਧੀਆ ਜੋਬ 'ਤੇ ਲੱਗ ਸਕੇ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕੇ ਆਪਣੇ ਵਰਤਣ ਲਈ ਕਿਸ ਤੋਂ ਪੈਸੇ ਨਾ ਮੰਗੇ ਜਿੰਨਾ ਉਸਦਾ ਖਰਚ ਹੋਵੇ ਉਹ ਆਪਣਾ ਖਰਚ ਆਪ ਪੂਰਾ ਕਰ ਸਕਦੀ ਹੋਵੇ ਮੈਂ ਕਲੱਬ ਦੀ ਮੈਂ ਰੀਡਿੰਗ ਕਲੱਬ ਵਿੱਚ ਸ਼ਾਮਿਲ ਹਾਂ ਮੈਂ ਉਸਦੀ ਇੱਕ ਖੁਦ ਮੈਂਬਰ ਹਾਂ ਮੈਂ ਉਸ ਕਲੱਬ ਵਿੱਚ ਜਾ ਕੇ ਪੜ੍ਹਦੀ ਹਾਂ ਕਿਸੇ ਔਰਤ ਦੀ ਜ਼ਿੰਦਗੀ ਬਾਰੇ ਵੀ ਪੜ੍ਹਦੀ ਹਾਂ ਮੈਨੂੰ ਇੱਥੇ ਜਾ ਕੇ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀਆਂ ਲੱਗਦੀਆਂ ਹਨ ਇਸ ਜਿਸ ਕਾਰਨ ਮੇਰੀ ਨੌਲੇਜ ਵਿੱਚ ਵੀ ਵਾਧਾ ਹੁੰਦਾ ਹੈ ਮੈਨੂੰ ਨਵੀਂ ਸਿੱਖਿਆ ਮਿਲਦੀ ਹੈ ਮੇਰੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ